ਮੈਂ ਅਨੁਭਵ ਸ਼ਰਮਾ ਪਿੰਡ ਪ੍ਰੇਮ ਨਗਰ ਜ਼ਿਲ੍ਹਾ ਐੱਸਬੀਐੱਸ ਨਗਰ ਦਾ ਵਾਸੀ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਮੇਰੇ ਜ਼ਿਲ੍ਹੇ ਵਿੱਚ ਰਿਹਾਇਸ਼ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਮੇਰੇ ਜ਼ਿਲ੍ਹੇ ਵਿੱਚ ਬਾਹਰੋਂ ਪ੍ਰਵਾਸੀ ਮਜ਼ਦੂਰ ਵੀ ਆਉਂਦੇ ਹਨ ਜਿਹੜੇ ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਫੈਕਟਰੀਆਂ ਹਨ ਜਿਸ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਖਾਤਰ ਲੋਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਸਾਡੇ ਜ਼ਿਲ੍ਹੇ ਵਿੱਚ ਆਪਣੇ ਰਿਹਾਇਸ਼ੀ ਵਧਾਈ ਹੈ ਕਿਰਾਏ 'ਤੇ ਵੀ ਰਹਿੰਦੇ ਹਨ ਕਈ ਕਈਆਂ ਨੇ ਆਪਣਾ ਘਰ ਨਵਾਂ ਪਾ ਲਿਆ ਅਤੇ ਇਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਵਿੱਚ ਕੋਲੇਜ ਵੀ ਹਨ ਬਹੁਤ ਸਾਰੇ ਜਿਵੇਂ ਸਾਡੇ ਲੈਮਰਿਨ ਟੈਕ ਸਕਿੱਲਸ ਯੂਨੀਵਰਸਿਟੀ ਦੁਆਬਾ ਕੋਲੇਜ ਆਦਿ ਸਾਡੇ ਘਰ ਤੋਂ ਜ਼ਿਆਦਾ ਦੂਰੀ 'ਤੇ ਨਹੀਂ ਹਨ ਇਸ ਕਰਕੇ ਇੱਥੇ ਬਾਹਰੋਂ ਪੜ੍ਹਨ ਵਾਲੇ ਬੱਚੇ ਵੀ ਬਹੁਤ ਸਾਰੇ ਆਉਂਦੇ ਹਨ ਅਤੇ ਕਈ ਲੋਕਾਂ ਨੇ ਆਪਣੇ ਪਿੰਡਾਂ ਵਿੱਚ ਹੀ ਆਪਣੇ ਘਰਾਂ ਦੇ ਉੱਤੇ ਚਾਹੇ ਘਰਾਂ 'ਚ ਹੀ ਪੀਜੀ ਬਣਾਏ ਹਨ ਜਾਂ ਫਿਰ ਘਰਾਂ 'ਚ ਖਾਲੀ ਕਮਰੇ ਕਿਰਾਏ 'ਤੇ ਦਿੱਤੇ ਹਨ ਜਿਸ ਵਿੱਚ ਸਟੂਡੈਂਟਸ ਰਹਿ ਸਕਦੇ ਹਨ ਅਤੇ ਪੜ੍ਹਾਈ ਪੂਰੀ ਕਰਦੇ ਹਨ